ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਇਤਿਹਾਸਿਕ ਮਹੱਤਤਾ ਬਹੁਤ ਹੀ ਜਿਆਦਾ ਹੈ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਸਹਿਰ ਹੈ ਅਤੇ ਹਰਿਮੰਦਰ ਸਾਹਿਬ ਦੀ ਦੀ ਨੀਂਹ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਨੇ ਸਾਈ ਮੀਆ ਮੀਰ ਜੀ ਪਾਸੋਂ ਰਖਵਾਈ ਸੀ ਹਰਿਮੰਦਰ ਸਾਹਿਬ ਇੱਕ ਅਜਿਹਾ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤਾ ਜੋ ਕਿ ਪੂਰੀ ਇਨਸਾਨੀਅਤ ਮਨੁੱਖਤਾ ਤੇ ਭਲੇ ਦਾ ਹੀ ਰਾਹ ਪੈਦਾ ਕਰਕੇ ਇਸ ਧਰਤੀ ਉੱਪਰ ਪਰਮਾਤਮਾ ਦਾ ਰੂਪ ਪ੍ਰਗਟ ਕਰਨ ਵਿੱਚ ਆਪਣਾ ਯੋਗਦਾਨ ਨਿਭਾ ਰਿਹਾ ਹੈ ਇਹਦੇ ਚੌਹ ਦਰਵਾਜ਼ੇ ਚਾਰੇ ਵਰਨਾਂ ਨੂੰ ਹਮੇਸ਼ਾ ਲਈ ਖੁੱਲੇ ਹਨ ਇਸ ਸਥਾਨ ਉੱਪਰ ਕਿਸੇ ਵੀ ਵਰਨ ਨੂੰ ਆਉਣ ਤੋਂ ਨਹੀਂ ਰੋਕਿਆ ਜਾਂਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸਨਾ ਕਰਨ ਤੋਂ ਬਾਅਦ ਗੱਦੀ ਨੂੰ ਸੁਸ਼ੋਭਿਤ ਕਰਦੇ ਹੋਏ ਪਾਠ ਆਰੰਭ ਕੀਤੇ ਗਏ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ ਇਸ ਸਥਾਨ ਉੱਪਰ ਸੰਗਤਾਂ ਮੱਥਾ ਟੇਕਣ ਆਉਂਦੀਆਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ ਇਸ ਨਾਲ ਇਸ ਸਮੁੱਚੇ ਇਲਾਕੇ ਵਿੱਚ ਇੱਕ ਚੇਤਨਤਾ ਅਤੇ ਆਪਸੀ ਭਾਈਚਾਰਾ ਪੈਦਾ ਹੋਇਆ ਜਿਸ ਨੇ ਅੱਗੇ ਜਾ ਕੇ ਸਿੱਖ ਧਰਮ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਚੰਗੀ ਭੂਮਿਕਾ ਨਿਭਾਈ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਸਦਾ ਹੀ ਪੰਜਾਬੀਆਂ ਅਤੇ ਅਤੇ ਸਿੱਖਾਂ ਦੀ ਏਕਤਾ ਦਾ ਕੇਂਦਰ ਬਣਿਆ ਹੋਇਆ ਹੈ ਇਸ ਸਥਾਨ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਦੁਆਰਾ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿੱਥੇ ਸਿੱਖੀ ਢੰਗ ਤਰੀਕੇ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲੇ ਕੀਤੇ ਜਾਂਦੇ ਹਨ ਹਰਿਮੰਦਰ ਸਾਹਿਬ ਪੰਜਾਬ ਦੇ ਇਤਿਹਾਸ ਵਿੱਚ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿ ਇਸ ਸਥਾਨ ਨੇ ਬਹੁਤ ਹੀ ਜੰਗਾਂ ਤੇ ਯੁੱਧਾਂ ਨੂੰ ਆਪਣੇ ਉੱਪਰ ਝੱਲਿਆ ਹੈ ਇਸ ਸਥਾਨ ਦੀ ਮਹੱਤਤਾ ਇਸ ਲਈ ਵੀ ਹੈ ਕਿ ਸਿੱਖਾਂ ਨੂੰ ਪੰਜਾਬ ਨੂੰ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਭਾਈਚਾਰੇ ਨੂੰ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਇਸ ਅਸਥਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਸਥਾਨ ਅਕਾਲ ਪੁਰਖ ਪਰਮਾਤਮਾ ਨੇ ਪ੍ਰਗਟ ਕੀਤਾ ਹੈ ਉਸਨੂੰ ਕਦੇ ਖਤਮ ਨਹੀਂ ਕਰ ਸਕੇ ਸਗੋਂ ਇਸ ਦੇ ਉਲਟ ਜਦੋਂ ਵੀ ਕਿਸੇ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅਕਾਲ ਪੁਰਖ ਦੀ ਮਰਜ਼ੀ ਨਾਲ ਉਹ ਅਹਿਸਾਨ ਜਰੂਰ ਖਤਮ ਹੋਏ ਹਨ ਮੁਗਲ ਕਾਲ ਤੋਂ ਲੈ ਕੇ ਹੁਣ ਦੇ ਕਾਲ ਤੱਕ ਹਰਿਮੰਦਰ ਸਾਹਿਬ ਸਿੱਖਾਂ ਦੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਸਥਾਨ ਹੈ ਇਸ ਸਥਾਨ ਨੇ ਹੀ ਸਮੁੱਚੇ ਪੰਜਾਬ ਭਾਰਤ ਨੂੰ ਇੱਕ ਬਹੁਤ ਸੋਹਣਾ ਇਤਿਹਾਸ ਦਿੱਤਾ ਹੈ ਅਤੇ ਭਾਈਚਾਰੇ ਦਾ ਇੱਕ ਮਜਮ ਸਮੇਂ ਦਾ ਸਥਾਨ ਹੈ ਜਿੱਥੇ ਸਾਰੇ ਹਿੰਦੂ ਮੁਸਲਮਾਨ ਸਿੱਖ ਇਸਾਈ ਇਕੱਠੇ ਹੋ ਕੇ ਬੈਠ ਸਕਦੇ ਹਨ ਇਨਸਾਨੀਅਤ ਅਤੇ ਭਾਈਚਾਰੇ ਦੀ ਪ੍ਰਤੀਕ ਹਰਿਮੰਦਰ ਸਾਹਿਬ ਦੀ ਮਹੱਤਤਾ ਬਹੁਤ ਜਿਆਦਾ ਹੈ